ਜੇ ਆਪਾਂ ਗੱਲ ਕਰੀਏ ਪੰਜਾਬ ਵਿੱਚ ਸੇਵਾਵਾਂ ਦੀ ਜੋ ਕਿ ਇੱਕ ਆਮ ਨਾਗਰਿਕ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਉਹਨਾਂ ਵਿੱਚ ਬਹੁਤ ਸਾਰੀਆਂ ਸੇਵਾਵਾਂ ਮੌਜੂਦ ਹਨ ਜਿਵੇਂ ਕਿ ਆਪਾਂ ਗੱਲ ਕਰੀਏ ਲਾਈਸੈਂਸ ਦੀ ਪਰਮਿਟ ਦੀ ਸਰਟੀਫਿਕੇਟ ਦੀ ਜਾਂ ਫਿਰ ਆਪਣੀ ਕੋਈ ਫਰਦ ਜੋ ਕਿ ਜ਼ਮੀਨ ਦੀ ਫਰਦ ਹੈ ਜਾਂ ਫਿਰ ਕੋਈ ਆਪਣੀ ਸਿਹਤ ਦੇ ਪ੍ਰਤੀ ਜਾਂ ਫਿਰ ਕੋਈ ਆਪਣੇ ਆਉਣ ਜਾਣ ਦੇ ਵਹੀਕਲ ਜਾਂ ਆਪਣੇ ਕੋਈ ਕਿਸੇ ਵੀ ਡਾਕੂਮੈਂਟ ਜਾਂ ਕਾਗਜ਼ੀ ਕਾਰਵਾਈ ਦੇ ਪ੍ਰਤੀ ਆਪਾਂ ਨੂੰ ਕੋਈ ਕੰਮ ਹੈ ਤਾਂ ਉਹ ਸਰਕਾਰ ਆਪਾਂ ਨੂੰ ਵੱਖ ਵੱਖ ਕੇਂਦਰਾਂ ਰਾਹੀਂ ਮੁਹੱਈਆ ਕਰਵਾਉਂਦੀ ਹੈ ਜਿਵੇਂ ਵੀ ਜਿਵੇਂ ਵੀ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਡਰਾਈਵਿੰਗ ਲਾਈਸੈਂਸ ਦੀ ਜਿਵੇਂ ਹੁਣ ਇੱਕ ਆਮ ਨਾਗਰਿਕ ਨੇ ਡਰਾਈਵਿੰਗ ਲਾਈਸੈਂਸ ਬਣਾਉਣਾ ਹੈ ਤਾਂ ਉਸਨੂੰ ਸਰਕਾਰ ਨੇ ਦਫਤਰ ਜਿਸ ਨੂੰ ਆਰ ਟੀ ਓ ਦਫ਼ਤਰ ਰੋਡ ਟਰਾਂਸਪੋਰਟ ਆਫਿਸ ਦੇ ਨਾਂ ਨਾਲ ਜੋ ਕਿ ਦਫ਼ਤਰ ਜਾਣਿਆ ਜਾਂਦਾ ਹੈ ਇੱਕ ਦਫ਼ਤਰ ਖੋਲਿਆ ਹੋਇਆ ਹੈ ਜਿਸ ਵਿੱਚ ਇੱਕ ਨਾਗਰਿਕ ਜਾ ਕੇ ਆਪਣਾ ਲਾਈਸੈਂਸ ਅਪਲਾਈ ਕਰ ਸਕਦਾ ਹੈ ਪ੍ਰਾਪਤ ਕਰ ਸਕਦਾ ਹੈ ਉਸਨੂੰ ਪ੍ਰਾਪਤ ਕਰਨ ਲਈ ਜੋ ਟੈਸਟ ਹਨ ਜੋ ਉਸਦੀ ਐਲੀਜੀਬਿਲਟੀਆਂ ਹਨ ਉਸ ਲਈ ਪੁੱਛ ਸਕਦਾ ਹੈ ਇਨਕੁਆਇਰੀ ਕਰ ਸਕਦਾ ਹੈ ਅਪਲਾਈ ਕਰ ਸਕਦਾ ਹੈ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਸੇਵਾਵਾਂ ਹਨ ਜਿਵੇਂ ਕਿ ਕਿਸੇ ਨੇ ਕੋਈ ਜਾਤੀ ਸਰਟੀਫਿਕੇਟ ਅਪਲਾਈ ਕਰਨਾ ਹੈ ਜਾਂ ਪ੍ਰਾਪਤ ਕਰਨਾ ਹੈ ਤਾਂ ਉਹ ਸੁਵਿਧਾ ਕੇਂਦਰ ਵਿੱਚ ਜਾ ਸਕਦਾ ਹੈ ਕਿਸੇ ਨੇ ਕੋਈ ਪਰਮਿਟ ਅਪਲਾਈ ਕਰਨਾ ਹੈ ਜਾਂ ਪ੍ਰਾਪਤ ਕਰਨਾ ਹੈ ਡੀ ਸੀ ਆਫਿਸ ਜੇ ਸਾਡੇ ਕੋਈ ਵੀ ਨਗਰਪਾਲਿਕਾ ਆਫਿਸ ਦੇ ਵਿੱਚ ਜਾ ਸਕਦਾ ਹੈ ਜੇ ਆਪਾਂ ਗੱਲ ਕਰੀਏ ਲੈਂਡ ਰਿਕਾਰਡ ਦੀ ਕਿਸੇ ਨੇ ਕੋਈ ਆਪਣੀ ਜ਼ਮੀਨ ਦੀ ਫਰਦ ਲੈਣੀ ਹੈ ਜ਼ਮੀਨ ਸਬੰਧੀ ਕੋਈ ਕਾਗਜ਼ ਲੈਣਾ ਹੈ ਜਾਂ ਜ਼ਮੀਨ ਦੀ ਲੈ ਵੇਚ ਕਰਨੀ ਹੈ ਤਾਂ ਉਹ ਆਪਣੇ ਸਰਕਾਰ ਦੁਆਰਾ ਨਿਯੁਕਤ ਕੀਤੇ ਪਟਵਾਰੀਆਂ ਨਾਲ ਸੰਪਰਕ ਕਰ ਸਕਦਾ ਹੈ ਇਸ ਤਰ੍ਹਾਂ ਨਾਲ ਹੀ ਆਪਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਾਂ ਧੰਨਵਾਦ